ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਹੈ ਵਧੀਆ ਵਧੀਆ ਹਾਂ ਵਧੀਆ ਵਧੀਆ ਵਧੀਆ ਵੀਰ ਜੀ ਇੱਕ ਮਾਨਸਾ ਆਵਾਜਾਈ ਬਾਰੇ ਪੁੱਛਣਾ ਸੀ ਕੀ ਗੱਲ ਬਾਤ ਹੈ ਯਾਨੀ ਕਿ ਹਾਂ ਹਾਂ ਹਾਂ ਬਹੁਤ ਆਵਾਜਾਈ ਹੈ ਜ਼ਿਆਦਾ ਸਾਰੇ ਕਿਤੇ ਬੁਰਾ ਹਾਲ ਹੈ ਬਾਜਾਰ 'ਚ ਘੰਟਾ ਘੰਟਾ ਫਾਟਕ ਨਹੀਂ ਖੁੱਲ੍ਹਦਾ ਹਾਂ ਉਰੇ ਨਾਲ ਦੀ ਸੜਕ ਜਾਂਦੀ ਉਹ 'ਤੇ ਵੀ ਆਵਾਜਾਈ ਬਹੁਤ ਹੁੰਦੀ ਆ ਬੁਰਾ ਹਾਲ ਜੀ ਬਜ਼ਾਰ 'ਚ ਕੋਈ ਜਾਮ ਲੱਗ ਜਾਵੇ ਬਹੁਤ ਪਰੇਸ਼ਾਨੀ ਟਰੈਫਿਕ ਬਾਹਲੀ ਹੁੰਦੀ ਹੈ ਬਜ਼ਾਰ 'ਚ ਵੀ

ਬੁਰਾ ਹਾਲ ਹੋ ਜਾਂਦਾ ਆਹ ਦੋ ਤਿੰਨ ਕੋਨੇ ਹੀ ਬੱਸ ਸਟੈਂਡ

ਹਾਂ ਹਾਂ ਜੀ ਆਵਾਜਾਈ ਦਾ ਬਹੁਤ ਬੁਰਾ ਹਾਲ ਹੈ ਹਾਂ ਹਾਂ ਠੀਕ ਹੈ ਹੋਰ ਠੀਕ ਹੈ ਵੀਰ ਜੀ ਧੰਨਵਾਦ